ਬ੍ਰਹਿਮੰਡ ਵਿੱਚ ਬਾਰੇ ਵਿੱਚ ਕੁਝ ਅਜਿਹੀਆਂ ਚੀਜ਼ਾਂ ਹਨ ਜੋ ਅਜੇ ਵੀ ਅਣਸੁਲਝੀਆਂ ਹੋਈਆਂ ਹਨ ਅਤੇ ਹੋਰ ਖੋਜ ਦੀ ਲੋੜ ਹੈ ਡਾਕਟਰ ਸੈਂਟਰ ਅਤੇ ਡਾਰਕ ਅਲੈਥੀ ਇਹ ਬ੍ਰਹਿਮੰਡ ਦਾ ਵੱਡਾ ਹਿੱਸਾ ਬਣਾਉਂਦੇ ਹਨ ਪਰ ਅਸੀਂ ਅੱਜ ਤੱਕ ਇਹਨਾਂ ਦੀ ਬਚਾਓ ਅਤੇ ਰਚਨਾ ਬਾਰੇ ਬਹੁਤ ਘੱਟ ਜਾਣਦੇ ਹਾਂ ਬ੍ਰਹਿਮੰਡ ਦੀ ਸ਼ੁਰੂਆਤ ਵਿਗਵੈਗ ਦੇ ਸਹੀ ਮਕੈਨਜਮ ਅਤੇ ਉਸ ਤੋਂ ਪਹਿਲਾਂ ਹਦਾਇਤਾਂ ਬਾਰੇ ਅਜੇ ਵੀ ਕਈ ਸਵਾਲ ਹਨ ਕਾਲੇ ਛਿੱਤਰ ਕਾਲੇ ਚਿੱਤਰ ਅਰਦੂਨੀ ਬਣਾਉਣ ਦੇ ਰੈਕਿੰਗ ਰਡੇਸ਼ਨ ਅਤੇ ਸਿਧਾਂਤਾਂ ਨੂੰ ਪੂਰੀ ਤਰ੍ਹਾਂ ਸਮਝਣ ਦੀ ਖੋਜ ਦੀ ਲੋੜ ਹੈ ਪੈਦਾ ਹੋਣ ਵਾਲੇ ਨਵੇਂ ਗ੍ਰਹਿ ਅਤੇ ਭਾਰੇ ਨਵੇਂ ਤਾਰਿਆਂ ਅਤੇ ਗ੍ਰਹਿਆਂ ਬਨਾਵਟ ਕਿਹੋ ਜਿਹੀ ਹੁੰਦੀ ਹੈ ਕਿਸੇ ਪ੍ਰਕਾਰਿਆਂ ਅਜੇ ਵੀ ਪੂਰੀ ਤਰ੍ਹਾਂ ਸਮਝਣ ਦੇ ਯੋਗ ਨਹੀਂ ਹੈ ਬ੍ਰਹਿਮੰਡ ਦੀ ਬਸਤੀ ਵਿੱਚ ਅਜਿਹੀ ਅਜੇ ਤੱਕ ਕੋਈ ਨਹੀਂ ਜਾਣਦੇ ਕਿ ਬ੍ਰਹਿਮੰਡ ਵਿੱਚ ਕਿਹੋ ਜਿਹੀ ਚੀਜ਼ ਹੋਰ ਮੌਜੂਦ ਹਨ ਜਾਂ ਨਹੀਂ ਹਨ ਗਰੈਵਿਟੀ ਅਜਿਹਾ ਸਿਧਾਂਤ ਦਾ ਮਕੈਨਿਕਮ ਐਨਕੈਨਸ਼ੀਅਮ ਅਤੇ ਜਰਨਲ ਗਲੈਸਕੀ ਦੇ ਨਜ਼ਰੇ ਜੋੜਦੀ ਹੈ ਅਜੇ ਤਾਂ ਪੂਰੀ ਤਰ੍ਹਾਂ ਵਿਕਸਿਤ ਨਹੀਂ ਹੈ ਇਹਨਾਂ ਦੇ ਹਾਲੇ ਹੋਰ ਗੁੰਝਲਾਂ ਬਾਰੇ ਹੋਰ ਖੋਜ ਅਤੇ ਅਧਿਐਨ ਦੀ ਲੋੜ ਹੈ ਜੋ ਕਿ ਬ੍ਰਾਹਿਮੰਡ ਨੂੰ ਵਧੀਆ ਢੰਗ ਨਾਲ ਸਮਝ ਸਕੀਏ ਹਾਲੇ ਵੀ ਸਾਨੂੰ ਬ੍ਰਹਿਮੰਡ ਵਿੱਚ ਅਣਸੁਲਝੇ ਬਹੁਤ ਗ੍ਰਹਿ ਹਨ ਜਾਂ ਹੋਰ ਵੀ ਹਨ ਜੋ ਕਿ ਸਾਨੂੰ ਸਮਝ ਨਹੀਂ ਆਉਂਦੀ ਇਹ